ਜਦੋਂ ਮੈਂ ਰਾਤ ਦੇ ਖਾਣੇ ਲਈ ਪਾਸਤਾ ਪਕਾ ਰਹੀ ਸੀਗੀ ਤਾਂ ਪਾਣੀ ਉਬਲਦੇ ਹੋਏ ਦੇ ਵਿੱਚ ਦੇਖਿਆ ਕਿ ਉਸ ਦਾ ਰੰਗ ਕੁਛ ਹੋਰ ਹੀ ਆ ਰਿਹਾ ਹੈ ਤਾਂ ਖਾਣਾ ਬਣਾਉਂਦੇ ਹੋਏ ਸਮਝ ਆਇਆ ਕਿ ਇਹ ਕੋਈ ਆਮ ਪਾਣੀ ਨਹੀਂ ਹੈ ਇੱਕ ਦੂਸ਼ਿਤ ਵਾਤਾਵਰਣ ਦਾ ਪਾਣੀ ਹੈ ਜਿਹੜਾ ਕਿ ਸਾਡੇ ਖਾਣੇ ਦੇ ਵਿੱਚ ਮਿਕਸ ਹੋ ਕੇ ਸਾਨੂੰ ਬਹੁਤ ਹੀ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਰਕੇ ਇਸਦੀ ਗੰਭੀਰਤਾ ਨੂੰ ਦੇਖਦੇ ਹੋਏ ਇਹਦੀ ਨੇੜਿਓਂ ਜਾਂਚ ਕੀਤੀ ਗਈ ਦੇਖਿਆ ਗਿਆ ਕਿ ਪਾਣੀ ਬਹੁਤ ਹੀ ਗੰਦਾ ਜਾਂ ਮਾੜਾ ਹੈ ਇਸ ਕਰਕੇ ਅਸੀਂ ਬਹੁਤ ਸਾਰੇ ਟੈਸਟ ਜਿਹੜੇ ਸੈਂਪਲਸ ਨੇ ਉਹ ਦੇਣ ਵਾਸਤੇ ਵਾਟਰ ਪਾਣੀ ਦੇ ਜਿਹੜੇ ਰਿਪੋਰਟ ਹੈ ਉਹ ਅਥੋਰਿਟੀ ਨੂੰ ਪਾਣੀ ਅਥੋਰਿਟੀ ਨੂੰ ਅਸੀਂ ਦਿੱਤੀ ਅਤੇ ਬੁਲਾ ਕੇ ਉਹਨਾਂ ਨੂੰ ਉਹਨਾਂ ਦੇ ਸੈਂਪਲਸ ਵੀ ਭੇਜੇ ਗਏ ਉਸ ਤੋਂ ਬਾਅਦ ਉਹਨਾਂ ਦੀ ਜਾਂਚ ਕਰਵਾਈ ਤਾਂ ਜਾਂਚ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਕਿ ਵਾਕੇ ਹੀ ਪਾਣੀ ਦੇ ਵਿੱਚ ਬਹੁਤ ਹੀ ਗੰਭੀਰ ਕੀਟਾਣੂ ਦਾ ਮਿਸ਼ਰਣ ਹੋ ਚੁੱਕਾ ਹੈ